ਖਾਣਾ ਬਣਾਉਣਾ ਵੀ ਇੱਕ ਕਲਾ ਹੈ ਇਹ ਕਲਾ ਮੈਂ ਆਪਣੇ ਮਾਤਾ ਜੀ ਤੋਂ ਸਿੱਖੀ ਹੈ ਮੈਨੂੰ ਹਮੇਸ਼ਾ ਉਹਨਾਂ ਦੀਆਂ ਬਣਾਈਆਂ ਹੋਈਆਂ ਸਬਜ਼ੀਆਂ ਅਤੇ ਉਹਨਾਂ ਦੀਆਂ ਬਣਾਈਆਂ ਹੋਈਆਂ ਮਿਠਾਈਆਂ ਪਸੰਦ ਆਈਆਂ ਹਨ ਇਸੇ ਕਰਕੇ ਮੈਂ ਹਮੇਸ਼ਾ ਉਹਨਾਂ ਨੂੰ ਆਪਣੇ ਧਿਆਨ ਵਿੱਚ ਰੱਖ ਕੇ ਆਪਣੀ ਰਸੋਈ ਦੇ ਵਿੱਚ ਜਾਂਦੀ ਹਾਂ ਅਤੇ ਭਗਵਾਨ ਦਾ ਨਾਮ ਲੈਂਦੇ ਹੋਏ ਆਪਣੇ ਰਸੋਈ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕਰਦੀ ਹਾਂ ਹਲੇ ਮੈਂ ਦੋ ਚਾਰ ਦਿਨ ਪਹਿਲਾਂ ਦੀ ਹੀ ਗੱਲ ਹੈ ਕਿ ਮੈਂ ਆਪਣੇ ਮੰਮਾ ਨਾਲ ਗੱਲ ਕਰ ਰਹੀ ਸੀ ਉਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਆਪਣੇ ਗਾਰਡਨ ਵਿੱਚ ਲਗਾਈਆਂ ਹੋਈਆਂ ਸਬਜ਼ੀਆਂ ਨੂੰ ਲੈ ਕੇ ਆਂਦਾ ਹੈ ਅਤੇ ਉਹਨਾਂ ਤੋਂ ਹੀ ਉਹਨਾਂ ਨੇ ਕੁਛ ਨਾ ਕੁਛ ਨਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੀ ਇਸ ਗੱਲ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਅਤੇ ਮੈਂ ਉਸੇ ਵੇਲੇ ਆਪਣੇ ਬਗੀਚੇ ਵਿੱਚ ਗਈ ਜਿੱਥੇ ਕਿ ਮੈਨੂੰ ਕੁਛ ਸਬਜ਼ੀਆਂ ਮਿਲ ਗਈਆਂ ਉਹਨਾਂ ਸਬਜ਼ੀਆਂ ਦੇ ਵਿੱਚ ਮੇਰੇ ਕੋਲੇ ਭਿੰਡੀਆਂ ਸਨ ਬੈਂਗਣ ਸਨ ਹਰੀਆਂ ਮਿਰਚਾਂ ਸਨ ਅਤੇ ਨਾਲ ਹੀ ਕੜ੍ਹੀ ਪੱਤਾ ਸੀਗਾ ਉਸਦੇ ਨਾਲ ਉੱਥੇ ਮੈਨੂੰ ਹਲ ਹਰੀ ਵਾਲੀ ਹਲਦੀ ਵੀ ਮਿਲ ਗਈ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਆਂਦਾ ਇਹਨਾਂ ਨੂੰ ਮੈਂ ਰਸੋਈ ਵਿੱਚ ਲਿਆ ਕੇ ਪਹਿਲਾਂ ਇਹਨਾਂ ਨੂੰ ਮੈਂ ਧੋਤਾ ਫਿਰ ਇਹਨਾਂ ਨੂੰ ਧੋ ਕੇ ਮੈਂ ਭਿੰਡੀਆਂ ਸੀਗੀਆਂ ਉਹਨਾਂ ਨੂੰ ਸਾਫ ਕੀਤਾ ਕੱਪੜੇ ਦੇ ਨਾਲ ਸਾਫ ਕਰਨ ਤੋਂ ਬਾਅਦ ਮੈਂ ਉਹਨਾਂ ਦੇ ਵਿੱਚ ਕੱਟ ਲਗਾਏ ਇਸੇ ਤਰ੍ਹਾਂ ਮੈਂ ਛੋਟੇ ਛੋਟੇ ਬੈਂਗਣ ਉਹਨਾਂ ਨੂੰ ਵੀ ਲੈ ਕੇ ਆਈ ਉਹਨਾਂ ਨੂੰ ਵੀ ਮੈਂ ਧੋਤਾ ਉਹਨਾਂ ਦੇ ਨਾਲ ਮੈਂ ਕੀ ਕੀਤਾ ਕਿ ਉਨ੍ਹਾਂ 'ਚ ਵੀ ਕੱਟ ਲਗਾਏ ਉਨ੍ਹਾਂ 'ਚ ਕੱਟ ਲਗਾਉਣ ਤੋਂ ਬਾਅਦ ਮੈਂ ਉਹਨਾਂ ਵਿੱਚ ਸੁੱਕੇ ਮਸਾਲੇ ਪਾਏ ਫਿਰ ਮੈਂ ਉਨ੍ਹਾਂ ਨੂੰ ਸਰ੍ਹੋਂ ਦੇ ਤੇਲ ਦੇ ਵਿੱਚ ਫਰਾਈ ਕੀਤਾ ਜਿਹੜੀ ਹਲਦੀ ਮੈਂ ਨਾਲ ਲੈ ਕੇ ਆਈ ਸੀਗੀ ਮੈਂ ਉਸਨੂੰ ਵੀ ਛਿਲਿਆ ਉਹਦੇ ਵਿੱਚ ਵੀ ਮੈਂ ਉਸ ਹਲਦੀ ਨੂੰ ਵੀ ਯੂਜ ਕੀਤਾ ਵਰਤਿਆ ਇਸੇ ਤਰ੍ਹਾਂ ਮੈਂ ਹੋਰ ਵੀ ਇਹਦੇ ਵਿੱਚ ਕੜ੍ਹੀ ਪੱਤੇ ਵੀ ਪਾਏ ਹੋਰ ਵੀ ਕਾਫੀ ਸੁੱਕੇ ਮਸਾਲੇ ਪਾ ਕੇ ਮੈਂ ਇਹ ਸਬਜ਼ੀਆਂ ਜਿਹੜੀਆਂ ਸੀ ਇਹਨਾਂ ਨੂੰ ਬਣਾਇਆ ਜਿਨਾਂ ਨੂੰ ਮੇਰੇ ਘਰ ਦੇ ਹਰੇਕ ਮੈਂਬਰ ਨੇ ਬਹੁਤ ਪਸੰਦ ਕੀਤਾ ਮੈਨੂੰ ਹਮੇਸ਼ਾ ਇਹ ਪ੍ਰੇਰਣਾ ਮੇਰੇ ਮੰਮੀ ਤੋਂ ਮਿਲਦੀ ਹੈ ਕਿ ਕਿਸ ਤਰ੍ਹਾਂ ਅਸੀਂ ਰਸੋਈ ਦੇ ਵਿੱਚ ਕੰਮ ਕਰਦੇ ਹੋਏ ਭਗਵਾਨ ਦਾ ਨਾਮ ਲੈਂਦੇ ਹੋਏ ਜੇ ਕੋਈ ਖਾਣਾ ਬਣਾਉਂਦੇ ਹਾਂ ਆਪਣੇ ਹੱਥਾਂ ਦੇ ਨਾਲ ਬਣਾਉਂਦੇ ਹਾਂ ਤਾਂ ਉਹ ਸਾਰਿਆਂ ਦੇ ਵਾਸਤੇ ਸਿਹਤ ਦਾ ਖਜ਼ਾਨਾ ਬਣ ਜਾਂਦਾ ਹੈ